ਸ਼ੁਰੂਆਤ ਕਰਨ ਵਾਲੇ ਪੰਛੀ ਨਿਗਰਾਨਾ ਲਈ ਮੇਰੇ ਕੋਲ ਕੁਛ ਅਜਿਹੇ ਸੁਝਾਅ ਹੈਗੇ ਨੇ ਜਿਸ ਨਾਲ ਉਹ ਆਪਣਾ ਹੁਨਰ ਨੂੰ ਹੋਰ ਸੁਧਾਰ ਸਕਦੇ ਨੇ ਜਿਸ ਤਰ੍ਹਾਂ ਅੱਜ ਕੱਲ੍ਹ ਕਾਫ਼ੀ ਕੁੱਤੇ ਅਵਾਰਾ ਕੁੱਤੇ ਜਿਹੜੇ ਕਿ ਉਹਨਾਂ ਪੰਛੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਸਭ ਤੋਂ ਪਹਿਲਾਂ ਤਾਂ ਉਹ ਆਪਣੇ ਹੱਥ ਵਿੱਚ ਹਮੇਸ਼ਾ ਇੱਕ ਡੰਡਾ ਫੜ ਕੇ ਰੱਖਣ ਅਤੇ ਸੀਟੀ ਵੀ ਆਪਣੇ ਕੋਲ ਰੱਖਣ ਜਿਸ ਨਾਲ ਕਿ ਉਹ ਇਹਨਾਂ ਜਾਨਵਰਾਂ ਨੂੰ ਇਹਨਾਂ ਪੰਛੀਆਂ ਤੋਂ ਦੂਰ ਰੱਖ ਸਕਦੇ ਆ ਕੁਛ ਵੱਡੇ ਜਾਨਵਰ ਅਤੇ ਕੁਛ ਵੱਡੇ ਪੰਛੀ ਵੀ ਇਹ ਕੁਛ ਛੋਟੇ ਪੰਛੀਆਂ ਦੇ ਉੱਪਰ ਹਮਲਾ ਕਰਦੇ ਨੇ ਪਰ ਉਹਨਾਂ ਨੂੰ ਨਿਗਰਾਨੀ ਕਰਨ ਲਈ ਉਹਨਾਂ ਦਾ ਧਿਆਨ ਰੱਖਣ ਲਈ ਇਹਨਾਂ ਨੂੰ ਹਮੇਸ਼ਾ ਆਪਣੇ ਚੁਸਤ ਦਰੁਸਤ ਰਹਿਣਾ ਚਾਹੀਦਾ ਹੈ ਨਿਗਰਾਨਾਂ ਨੂੰ ਇਹਨਾਂ ਨੂੰ ਹਰ ਵੇਲੇ ਉਹਨਾਂ ਦੀ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਉਹਨਾਂ ਦਾ ਖਾਣ ਪੀਣ ਦਾ ਵੀ ਧਿਆਨ ਦੇਣਾ ਚਾਹੀਦਾ ਹੈ ਟਾਈਮ ਦੇ ਟਾਈਮ ਨਾਲ ਉਹਨਾਂ ਨੂੰ ਕਿਹੜਾ ਦਾਣਾ ਪਾਉਣਾ ਕਿਹੜੇ ਪੰਛੀ ਨੂੰ ਕਿੱਦਾਂ ਦਾਣਾ ਪਾਉਣਾ ਹੈ ਅਤੇ ਕਿਹੜਾ ਦਾਣਾ ਦੇਣਾ ਹੈ ਉਹ ਉਹਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਕੁਛ ਪੰਛੀ ਮੌਸਮ ਦੇ ਹਿਸਾਬ ਨਾਲ ਵੀ ਬਿਮਾਰ ਹੁੰਦੇ ਹਨ ਅਤੇ ਉਹਨਾਂ ਪੰਛੀਆਂ ਦੀ ਟਾਈਮ 'ਤੇ ਕਿਹੜੀ ਚੀਜ਼ ਉਹਨਾਂ ਨੂੰ ਦੇ ਕੇ ਠੀਕ ਕਰਨਾ ਹੈ ਕੁਛ ਪੰਛੀ ਬਸੰਤ ਦੇ ਦਿਨਾਂ ਵਿੱਚ ਜ਼ਖ਼ਮੀ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਪੂਰਾ ਧਿਆਨ ਦੇ ਕੇ ਉਹਨਾਂ ਦੀ ਜਿਹੜੀ ਸੱਟ ਚੋਟ ਆ ਉਹਨੂੰ ਠੀਕ ਕਰਨਾ ਚਾਹੀਦਾ ਹੈ ਧੰਨਵਾਦ